ਭੰਗੜਾ ਆਰੋਬਿਕਸ ਕੀ ਹੈ ਜਿਵੇਂ ਕਿ ਲੋਕ ਗਾਣੇ ਲਗਾ ਕੇ ਨੱਚਦੇ ਹਨ ਅਤੇ ਗਾਣੇ ਲਾ ਕੇ ਭੰਗੜਾ ਪਾ ਕੇ ਕਸਰਤ ਕਰਦੇ ਹਨ ਪਹਿਲਾਂ ਲੋਕ ਸਰੀਰਿਕ ਤੌਰ 'ਤੇ ਬਿਮਾਰ ਰਹਿੰਦੇ ਸਨ ਅਤੇ ਹੁਣ ਹੁਣ ਦਿਮਾਗੀ ਤੌਰ 'ਤੇ ਵੀ ਇੱਕ ਰੋਗੀ ਰਹਿੰਦੇ ਹਨ ਅਤੇ ਇੱਕ ਭੰਗੜਾ ਸਾਨੂੰ ਇੱਕ ਕਸਰਤ ਵੱਲੋਂ ਵੀ ਕਰਨਾ ਚਾਹੀਦਾ ਹੈ ਇਸ ਨਾਲ ਸਾਡੇ ਸਰੀਰ ਤੰਦਰੁਸਤ ਰਹਿੰਦਾ ਹੈ ਸਾਡਾ ਸਰੀਰ ਤਰੋ ਤਾਜ਼ਾ ਰਹਿੰਦਾ ਹੈ ਅਤੇ ਸਾਡੇ ਸਰੀਰ ਦੇ ਵਿੱਚ ਵਧੀਆ ਤਾਕਤ ਬਣੀ ਰਹਿੰਦੀ ਹੈ ਅਤੇ ਭੰਗੜਾ ਅਸੀਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹੁੰਦੇ ਹਾਂ ਉਦੋਂ ਕਰਦੇ ਹਾਂ ਗਾਣੇ ਲਗਾ ਕੇ ਕਰਦੇ ਹਾਂ ਯੋਗੇ ਲੋਕ ਕਰਦੇ ਹਾਂ ਅਤੇ ਇਸ ਨਾਲ ਸਾਡਾ ਸਰੀਰ ਸਹੀ ਰਹਿੰਦਾ ਹੈ ਭੰਗੜਾ ਸਾਨੂੰ ਕਰਨਾ ਚਾਹੀਦਾ ਹੈ ਅਤੇ ਖੁਸ਼ ਰਹਿਣ ਵਾਸਤੇ ਕਰਨਾ ਚਾਹੀਦਾ ਹੈ ਦਿਮਾਗ ਨੂੰ ਠੰਡਾ ਰੱਖਣ ਵਾਸਤੇ ਕਰਨਾ ਚਾਹੀਦਾ ਹੈ ਅਤੇ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਹਦੇ ਨਾਲ ਸਾਡੇ ਦਿਮਾਗ ਦੀ ਟੈਂਸ਼ਨ ਦੂਰ ਹੁੰਦੀ ਹੈ ਤੇ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਇਸ ਨੂੰ ਅਸੀਂ ਯੋਗੇ ਦੇ ਤੌਰ 'ਤੇ ਹੀ ਵਰਤ ਸਕਦੇ ਹਾਂ ਕਸਰਤ ਦੇ ਤੌਰ 'ਤੇ ਵੀ ਵਰਤ ਸਕਦੇ ਹਾਂ ਭੰਗੜਾ ਸਾਨੂੰ ਕਰਦੇ ਰਹਿਣ ਚਾਹੀਦਾ ਹੈ ਅਤੇ ਦਿਮਾਗ ਸਹੀ ਕੰਮ ਕਰਦਾ ਹੈ ਭੰਗੜਾ ਕਰਨ ਨਾਲ ਸਾਡਾ ਸਰੀਰ ਤਕੜਾ ਰਹਿੰਦਾ ਹੈ ਅਤੇ ਤਾਜ਼ਾ ਰਹਿੰਦਾ ਹੈ